ਇਹ ਇੱਕ ਬਹੁਤ ਚਿਰਾਂ ਦੀ ਪੁਰਾਣੀ ਗੱਲ ਹੈ ਸਾਡੇ ਪਿੰਡ ਦੀ ਆ ਪਿੰਡ ਘੁੱਦੇ ਦੀ ਗੱਲ ਹੈ ਅਤੇ ਦਸ ਪੰਦਰ੍ਹਾਂ ਸਾਲ ਪਹਿਲਾਂ ਇੱਕ ਬਹੁਤ ਵੱਡੀ ਆਫਤ ਆਈ ਸੀ ਕੁਦਰਤ ਵੱਲੋਂ ਅਤੇ ਪਿੰਡ ਇੰਨੇ ਗੜੇ ਪੈ ਗਏ ਸੀ ਅਤੇ ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਸੀ ਕਈ ਜਾਨਵਰ ਬਹੁਤ ਬਾਹਰ ਮਰ ਗਏ ਸੀ ਉੱਡਣ ਆਲੇ ਜਾਨਵਰ ਤਾਂ ਸੱਤਰ ਪਝੱਤਰ ਪ੍ਰਸੈਂਟ ਹੀ ਮਰ ਗਏ ਸੀ ਦਰਖਤ ਪੱਟੇ ਗਏ ਸੀ ਇਹ ਬਹੁਤ ਵੱਡੀ ਆਫਤ ਜਿਹੜੀ ਅਜੇ ਤੱਕ ਵੀ ਸਾਡੇ ਨ ਦਿਲਾਂ ਦੇ ਵਿੱਚ ਉਵੇਂ ਜਿਵੇਂ ਕਈ ਵਾਰੀ ਭਰ ਦਿੰਦੀ ਹੈ ਪਰ ਹੁਣ ਇਹ ਵੀ ਇਹ ਇੱਕ ਆਫਤ ਆਈ ਸੀ ਜਦੋਂ ਕਿ ਕਣਕਾਂ ਵੀ ਹੁਣ ਤਬਾਹ ਹੋ ਗਈਆਂ ਇਸੇ ਵਾਰੀ ਗੜੇ ਬਹੁਤ ਪਏ ਨੇ ਗੜੇ ਜਿੱਧਰ ਪਏ ਨੇ ਉਹ ਤਾਂ ਕਣਕਾਂ ਹੀ ਖਤਮ ਹੋ ਗਈਆਂ ਇਸ ਘਟਨਾ ਨੂੰ ਵੇਖ ਕੇ ਅਤੇ ਉਸ ਘਟਨਾ ਨੂੰ ਵੇਖ ਕੇ ਤਾਂ ਇਹ ਘਟਨਾ ਪੰਜਾਹ ਕੁ ਪ੍ਰਸੈਂਟ ਹੀ ਲੱਗਦੀ ਹੈ ਉਹ ਤਾਂ ਪੂਰੀ ਸੌ ਪ੍ਰਸੈਂਟ ਸੀ ਉਸ ਵੇਲੇ ਸਰਕਾਰ ਨੇ ਕਿਸਾਨਾਂ ਨੂੰ ਮਦਦ ਦਿੱਤੀ ਸੀ ਕਿਉਂਕਿ ਨਾ ਹੀ ਤਾਂ ਫਸਲਾਂ ਖਰਾਬ ਮਰ ਗਈਆਂ ਸੀ ਨਵੇਂ ਘਰ ਮਕਾਨ ਡਿੱਗ ਪਏ ਸੀ ਪਸ਼ੂ ਮਰ ਗਏ ਸੀ ਕੁਝ ਚਿਰ ਮਗਰੋਂ ਫਿਰ ਇਸੇ ਸਰਕਾਰ ਨੇ ਉਹ ਸਹਾਇਤਾ ਕਿਸਾਨਾਂ ਤੋਂ ਵਾਪਸ ਲੈ ਲਈ ਕਈਆਂ ਤੋਂ ਨਹੀਂ ਦਿੱਤੀ ਗਈ ਤਾਂ ਉਹਨਾਂ ਨੂੰ ਜੁਰਮਾਨਾ ਵੀ ਭਰਨਾ ਪਿਆ ਅਤੇ ਮ ਮਾਲ ਪਟਵਾਰੀ ਨਹਿਰੀ ਪਟਵਾਰੀ ਤਹਿਸੀਲਦਾਰ ਕਨਗੋ ਸਾਰੇ ਪਿੰਡਾਂ ਵਿੱਚ ਆਏ ਨਾਲ ਪੁਲਿਸ ਲਿਆਏ ਪਰ ਫਿਰ ਵੀ ਲੋਕਾਂ ਨੂੰ ਇਹਨਾਂ ਨੇ ਉਹ ਆਫਤ ਨਾ ਭੁੱਲਣ ਦੀ ਬਜਾਏ ਯਾਦ ਰੱਖਣ ਵਾਸਤੇ ਮਜ਼ਬੂਰ ਕਰਤਾ ਜੀ